ਮੈਨੂੰ ਬਚਪਨ ਤੋਂ ਹੀ ਪੜ੍ਹਨ ਦਾ ਬਹੁਤ ਸ਼ੌਕ ਸੀ ਮੈਂ ਸਕੂਲ ਦੀ ਲਾਇਬ੍ਰੇਰੀ ਵਿੱਚ ਨਿੱਤ ਜਾਇਆ ਕਰਦਾ ਸੀ ਸਾਡੇ ਸਕੂਲ ਦੀ ਲਾਇਬ੍ਰੇਰੀ ਬਹੁਤ ਵਧੀਆ ਅਤੇ ਸਾਫ਼ ਸੁਥਰੀ ਸੀ ਜਿੱਥੇ ਬੈਠਣ ਦੇ ਲਈ ਗੱਦੀਨੁਮਾ ਕੁਰਸੀਆਂ ਲੱਗੀਆਂ ਸਨ ਮੈਂ ਬਚਪਨ ਦੇ ਵਿੱਚ ਸਭ ਤੋਂ ਪਹਿਲਾਂ ਚਾਚਾ ਚੌਧਰੀ ਅਤੇ ਬਾਲ ਚੇਤਨਾ ਦੋ ਕਿਤਾਬਾਂ ਪੜ੍ਹੀਆਂ ਸਨ ਇਸ ਤੋਂ ਬਾਅਦ ਲਗਾਤਾਰ ਮੈਂ ਲਾਇਬ੍ਰੇਰੀ ਜਾਂਦਾ ਰਹਿੰਦਾ ਸੀ ਇਸ ਨਾਲ ਮੇਰਾ ਸ਼ੌਕ ਹੋਰ ਬਹੁਤ ਵੱਧ ਗਿਆ ਸੀ ਫਿਰ ਇਸ ਤੋਂ ਬਾਅਦ ਮੈਂ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਗੁਰਦਿਆਲ ਸਿੰਘ ਦੇ ਅਤੇ ਨਾਨਕ ਸਿੰਘ ਦੇ ਨਾਵਲ ਵੀ ਪੜ੍ਹੇ ਸਨ ਇਸ ਤੋਂ ਇਲਾਵਾ ਮੈਂ ਬੇਸਿਕ ਸਾਇੰਸ ਦੀਆਂ ਵੀ ਕੁਝ ਕਿਤਾਬਾਂ ਪੜ੍ਹੀਆਂ ਸਨ ਅਤੇ ਉਸ ਦੇ ਨਾਲ ਨਾਲ ਹਿੰਦੀ ਸਾਹਿਤ ਦੇ ਵਿੱਚੋਂ ਵੀ ਕੁਝ ਲੇਖਕਾਂ ਨੂੰ ਪੜ੍ਹਿਆ ਸੀ